ਪਿਛਲੇ ਹਫ਼ਤੇ ਅਸੀਂ ਮ ਮਨਾਲੀ ਘੁੰਮਣ ਗਏ ਜਦੋਂ ਉੱਥੇ ਅਸੀਂ ਪਹੁੰਚੇ ਤਾਂ ਉੱਥੇ ਦਾ ਮੌਸਮ ਬਹੁਤ ਹੀ ਵਧੀਆ ਸੀ ਉੱਥੇ ਦੇ ਪਹਾੜੀ ਏਰੀਆ ਦੇਖ ਕੇ ਸਾਡਾ ਬਹੁਤ ਹੀ ਮਨ ਖੁਸ਼ ਹੋਇਆ ਜਦੋਂ ਉੱਥੇ ਘੁੰਮਦੇ ਫਿਰਦੇ ਬਹੁਤ ਫੋਟੋਆਂ ਖਿੱਚੀਆਂ ਉੱਥੇ ਦੇ ਵਿਊ ਬਹੁਤ ਹੀ ਸੋਹਣੇ ਸੀ ਮਨਾਲੀ ਤੋਂ ਆਉਂਦੇ ਹੋਏ ਅਸੀਂ ਮਨੀਕਰਨ ਸਾਹਿਬ ਗੁਰਦੁਆਰੇ 'ਚ ਮੱਥਾ ਟੇਕਿਆ ਉੱਥੇ ਘੁੰਮੇ ਫਿਰੇ ਅਤੇ ਬਹੁਤ ਹੀ ਵਧੀਆ ਉੱਥੇ ਦਾ ਵਿਊ ਲੱਗਿਆ ਉੱਥੇ ਗੁਰਦੁਆਰਾ ਸਾਹਿਬ ਬਹੁਤ ਹੀ ਵਧੀਆ ਲੱਗਿਆ ਅਤੇ ਜਦੋਂ ਉੱਥੇ ਤੇ ਅਸੀਂ ਵਾਪਸ ਆ ਰਹੇ ਤੇ ਤਾਂ ਉੱਥੇ ਅਸੀਂ ਇੱਕ ਬਾਰਿਸ਼ ਹੋ ਰਹੀ ਤਾਂ ਬਾਰਿਸ਼ ਹੋਣ ਕਰਕੇ ਉੱਥੇ ਇੱਕ ਪਹਾੜ ਖਿਸਕ ਗਿਆ ਜਿਸ ਕਰਕੇ ਅਸੀਂ ਦੋ ਦਿਨ ਲ ਲੰਬੇ ਜਾਮ ਵਿੱਚ ਫਸੇ ਰਹੇ ਨਾ ਅੱਗੇ ਜਾਣ ਜੋਗੇ ਅਤੇ ਨਾ ਪਿੱਛੇ ਆਉਣ ਜੋਗੇ ਤੇ ਜਿਸ ਨਾਲ ਸਾਨੂੰ ਬਹੁਤ ਹੀ ਦਿੱਕਤ ਹੋਈ ਜੋ ਉੱਥੇ ਸਾਨੂੰ ਖਾਣ ਪੀਣ ਦੀ ਬਹੁਤ ਦਿੱਕਤ ਹੋਈ ਜਦੋ ਅਸੀਂ ਉੱਥੇ ਲਾਗ ਪਾਸ ਢਾਬਿਆਂ ਅਤੇ ਖਾਣ ਪੀਣ ਲਈ ਪੁੱਛਿਆ ਤਾਂ ਉਹ ਦੋ ਦੋਗ ਦੋ ਗੁਣਾ ਜ਼ਿਆਦਾ ਮਹਿੰਗੀਆਂ ਆਈਟਮਾਂ ਦੇ ਰਹੇ ਤੇ ਖਾਣ ਨੂੰ ਪਾਣੀ ਦੀ ਜਿਹੜੀ ਵੀਹ ਰੁਪਏ ਦੀ ਬੋਤਲ ਤੀ ਉਹ ਚਾਲੀ ਰੁਪਏ ਦੀ ਪੰਜਾਹ ਰੁਪਏ ਦੀ ਇਵੇਂ ਦੇ ਰਹੇ ਤੇ ਜਿਸ ਨਾਲ ਸਾਨੂੰ ਬਹੁਤ ਹੀ ਮੁਸ਼ਕਿਲ ਹੋਈ ਕਿਉਂਕਿ ਅਸੀਂ ਜੋ ਸਾਡੇ ਕੋਲ ਪੈਸੇ ਤੇ ਉਹ ਅਸੀਂ ਉੱਪਰ ਘੁੰਮਣ ਗਏ ਮਨੀਕਰਨ ਸਾਹਿਬ ਅਤੇ ਮਨਾਲੀ ਘੁੰਮਣ ਗਏ ਉੱਥੇ ਖਰਚ ਲਏ ਅਤੇ ਸਾਡੇ ਕੋਲ ਵਾਪਸ ਆਉਣ ਲੱਗੇ ਬਹੁਤ ਹੀ ਥੋੜ੍ਹੇ ਪੈਸੇ ਬੱਚ ਗਏ ਤੇ ਜਿਸ ਨਾਲ ਸਾਨੂੰ ਬਹੁਤ ਪ੍ਰੇਸ਼ਾਨੀ ਹੋਈ ਦੋ ਦਿਨ ਬਾਅਦ ਰੋਡ ਕਲੀਅਰ ਹੋਇਆ ਰੋਡ ਕਲੀਅਰ ਹੋਣ ਕਰਕੇ ਅਸੀਂ ਦੋ ਦਿਨ ਬਾਅਦ ਜਾਮ ਤੋਂ ਫਸਣ ਤੋਂ ਬਾਅਦ ਅਸੀਂ ਘਰ ਵਾਪਸ ਪਹੁੰਚੇ